ਹਾਂਜੀ ਮੈਂ ਪਟਿਆਲੇ ਦਾ ਰਹਿਣ ਵਾਲਾ ਮੈਂ ਪਟਿਆਲੇ ਦੇ ਹੈਲਥ ਸਿਸਟਮ ਨੂੰ ਬਹੁਤ ਵਧੀਆ ਸਮਝਦਾ ਹਾਂ ਕਿਉਂਕਿ ਇੱਥੇ ਬਹੁਤ ਜ਼ਿਆਦਾ ਸਰਕਾਰੀ ਅਤੇ ਗੈਰ ਸਰਕਾਰੀ ਹੋਸਪਿਟਲ ਹਨ ਅਤੇ ਹਰ ਸਮੇਂ ਇੱਥੇ ਚੌਵੀ ਘੰਟੇ ਜਿਹੜੀ ਹੈ ਐਮਰਜੈਂਸੀ ਖੁੱਲ੍ਹੀ ਰਹਿੰਦੀ ਹੈ ਅਤੇ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ